ਪੇਂਡੂ ਲੋਕਾਂ ਲਈ ਕਾਨੂੰਨੀ ਸੇਵਾਵਾਂ ਦਾ ਵਿੱਚ ਮੁਸ਼ਕਿਲਾਂ ਦਾ ਬਹੁਤ ਸਾਰਾ ਸਾਹਮਣਾ ਕਰਨਾ ਪੈਂਦਾ ਹੈ ਪਹਿਲੀ ਗੱਲ ਤਾਂ ਪਿੰਡਾਂ ਦੇ ਲੋਕ ਜ਼ਿਆਦਾਤਰ ਅਨਪੜ੍ਹ ਹੁੰਦੇ ਆ ਉਹਨਾਂ ਨੂੰ ਆਪਣੇ ਰਾਈਟਸ ਕਾਨੂੰਨੀ ਸੇਨ ਸੇਵਾਵਾਂ ਬਾਰੇ ਘੱਟ ਪਤਾ ਹੁੰਦਾ ਦੂਸਰੀ ਗੱਲ ਇਹ ਹੈ ਕਿ ਔਨਲਾਈਨ ਸਿਸਟਮ ਹੋਣ ਕਰਕੇ ਕਾਫੀ ਪੇਂਡੂ ਲੋਕਾਂ ਨੂੰ ਇਹ ਹੋ ਗਿਆ ਹੈ ਕਿ ਉਹਨਾਂ ਨੂੰ ਫਾਰਮ ਸਹੀ ਨਹੀਂ ਭਰਨੇ ਆਉਂਦੇ ਫਾਰਮ ਸਹੀ ਨਹੀਂ ਭਰਨ ਆਉਣ ਕਰਕੇ ਉਹਨਾਂ ਤੋਂ ਉਹ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਦੂਸਰੀ ਗੱਲ ਇਹ ਹੈ ਕਿ ਪੇਂਡੂ ਲੋਕਾਂ ਨੂੰ ਇਹ ਕਾਨੂੰਨੀ ਸੈਨਾ ਸੇਨਾ ਸੇਵਾਵਾਂ ਬਾਰੇ ਜਾਣਕਾਰੀ ਵੀ ਨਹੀਂ ਹੁੰਦੀ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਅਸੀਂ ਕਿਹ ਕਿਹੜੀ ਚੀਜ਼ ਦੀ ਕਿਸ ਕਿੱਥੇ ਤੱਕ ਇਹ ਸੁਣਵਾਈ ਹੋਣੀ ਹੈ ਸਾਨੂੰ ਕਿੱਥੇ ਜਾਣਾ ਚਾਹੀਦਾ ਹੈ ਸਾਡੀ ਕਿਵੇਂ ਸਾਡੀ ਇਸ ਮੁਸ਼ਕਿਲ ਦਾ ਅਸੀਂ ਕਿਵੇਂ ਸਾਹਮਣਾ ਕਰ ਸਕਦੇ ਹਾਂ ਅਸੀਂ ਕਿਹਨੂੰ ਮਿਲਣਾ ਹੈ ਉਹ ਅਸੀਂ ਕਿਸ ਬੰਦੇ ਕੋਲ ਜਾਣਾ ਹੈ ਦੂਸਰੀ ਗੱਲ ਇਹ ਹੈ ਕਿ ਉਹਨਾਂ ਨੂੰ ਫਿਰ ਉੱਥੇ ਅ ਦਫ਼ਤਰਾਂ ਵਿੱਚ ਧੱਕੇ ਖਾਣੇ ਪੈਂਦੇ ਹਨ ਕਿਉਂਕਿ ਨਾ ਤਾਂ ਹੀ ਦਫ਼ਤਰਾਂ 'ਚ ਆਪਾਂ ਨੂੰ ਇੰਨੀ ਸੁਵਿਧਾ ਹੁੰਦੀ ਹੈ ਕਿ ਆਪਾਂ ਨੂੰ ਹਰ ਚੀਜ਼ ਬਾਰੇ ਕੋਈ ਗਾਈਡ ਕਰਨ ਲਈ ਖੜ੍ਹਾ ਹੋਵੇ ਹਰ ਚੀਜ਼ ਲਈ ਕੋਈ ਨਾ ਕੋਈ ਫਾਰਮ ਭਰਨਾ ਹੁੰਦਾ ਆਪਾਂ ਨੂੰ ਕਿਸੇ ਨੂੰ ਮਿਲਣਾ ਹੁੰਦਾ ਹੈ ਜਦੋਂ ਉਹਨਾਂ ਨੂੰ ਇਹ ਨਾ ਤਾਂ ਫਾਰਮ ਭਰੇ ਜਾਂਦੇ ਹਨ ਨਾ ਉਹਨਾਂ ਨੂੰ ਪਤਾ ਹੁੰਦਾ ਦੂਸਰੀ ਗੱਲ ਇਹ ਹੈ ਕਿ ਕਾਨੂੰਨੀ ਸੇਵਾ ਆਪਾਂ ਕਈ ਵਾਰੀ ਫੋਨ ਦੀ ਮਦਦ ਨਾਲ ਦੇਖ ਲੈਂਦੇ ਹਾਂ ਕਿ ਇਹਦੇ ਲਈ ਕਿਹੜਾ ਫਾਰਮ ਲੱਗਣਾ ਹੈ ਕਿਵੇਂ ਲੱਗਣਾ ਹੈ ਉਹ ਵੀ ਪੇਂਡੂ ਲੋਕਾਂ ਨੂੰ ਪ ਘੱਟ ਪਤਾ ਹੁੰਦਾ ਦੂਸਰੇ ਪਿੰਡਾਂ ਨੇ ਸਾਧਨ ਘੱਟ ਹੋਣ ਕਰਕੇ ਉਹ ਆਪਣੀ ਪੂਰੀ ਪਹਿਲਾਂ ਉਹ ਸ਼ਹਿਰ 'ਚ ਆਉਣ ਜਾਂ ਆਪਣੇ ਕਿਸੇ ਕਾਨੂੰਨੀ ਦਫ਼ਤਰ 'ਚ ਜਾਣ ਕਾਨੂੰਨੀ ਸੇਵਾ ਲੈਣ ਲਈ ਆਪਣੇ ਪਿੰਡ ਦੇ ਨੀਚੇ ਪੈਂਦੇ ਦਫ਼ਤਰ 'ਚ ਜਾਣ ਉੱਥੇ ਵੀ ਉਹ ਪਹੁੰਚ ਨਹੀਂ ਸਕਦੇ ਅਤੇ ਉੱਥੇ ਜਾ ਕੇ ਆਪਣੀ ਅੱਗੇ ਦੀ ਕਾਰਵਾਈ ਕਰਨ 'ਚ ਬਹੁਤ ਸਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ